ਸਾਡੇ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਿਕ ਥਾਂ ਹੈ ਜੋ ਕਿ ਬਟਾਲੇ ਸ਼ਹਿਰ ਦੇ ਵਿੱਚ ਸਥ ਸਥਿਰ ਸਥਾਪਿਤ ਇ ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਵਿਆਹੁਣ ਵਾਸਤੇ ਆਏ ਹੋਏ ਸਨ ਜੋ ਕਿ ਅੱਜ ਵੀ ਇੱਥੇ ਨਿਸ਼ਾਨੀ ਤੌਰ 'ਤੇ ਕੰਧ ਸਾਹਿਬ ਹੈ ਜਿਸ ਵਿੱਚ ਕੰਧ ਸਾਹਿਬ ਹੈ ਜਿਸ ਵਿੱਚ ਲੋਕੀ ਆਖਦੇ ਸਨ ਕਿ ਬਾਬਾ ਜੀ ਇਹ ਕੰਧ ਡਿੱਗ ਪੈਣੀ ਹੈ ਤੁਸੀਂ ਇਸ 'ਤੇ ਨਾ ਬੈਠੋ ਬਾਬਾ ਜੀ ਨੇ ਕਿਹਾ ਵੀ ਇਹ ਕੰਧ ਜਿਹੜੀ ਹੈ ਜੁਗੋ ਜੁਗ ਰਹਿਣ ਵਾਲੀ ਹੈ ਇਸ ਕੰਧ ਕਦੇ ਨਹੀਂ ਡਿੱਗ ਡਿੱਗ ਸਕਦੀ ਉਸ ਦਿਨ ਤੋਂ ਲੈ ਕੇ ਅੱਜ ਦਿਨ ਤੱਕ ਬਾਬਾ ਜੀ ਦੇ ਵਿਆਹ ਦੀ ਯਾਦ ਵਿੱਚ ਉਹ ਕੰਧ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਖੜ੍ਹੀ ਹੈ ਜਿਸ ਦਾ ਆਏ ਸਾਲ ਹੀ ਵਿਆਹ ਪੁਰਬ ਉੱਥੇ ਮਨਾਇਆ ਜਾਂਦਾ ਹੈ ਦੂਰੋਂ ਦੂਰੋਂ ਸੈਲਾਨੀ ਉੱਥੇ ਵੇਖਣ ਆਉਂਦੇ ਹਨ ਅਤੇ ਜੋ ਇੱਥੋਂ ਦੇ ਸੈਲਾਨੀ ਵੇਖਣ ਆਉਂਦੇ ਹਨ ਅਤੇ ਬਹੁਤ ਧੂਮ ਧਾਮ ਨਾਲ ਇੱਥੇ ਮੇਲਾ ਮਨਾਇਆ ਜਾਂਦਾ ਸਭ ਸੰਗਤਾਂ ਇੱਥੇ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ